ਸਕੂਲ ਤੋਂ ਬਾਅਦ ਜੋ ਸ਼ਾਮ ਦੀ ਟਿਊਸ਼ਨ ਜਾਂ ਪ੍ਰਾਈਵੇਟ ਕਲਾਸਾਂ ਅੱਜ ਕੱਲ੍ਹ ਚੱਲ ਰਹੀਆਂ ਹਨ ਜਾਂ ਬਹੁਤ ਹੀ ਚਰਚਾ ਦੇ ਵਿੱਚ ਹਨ ਜਿਸ ਨੂੰ ਕਿ ਅੱਜ ਕੱਲ੍ਹ ਆ ਆਪਣਾ ਪੜ੍ਹਿਆ ਲਿਖਿਆ ਸਮਾਜ ਬਹੁਤ ਜ਼ਿਆਦਾ ਤਵੱਜੋ ਵੀ ਦੇ ਰਿਹਾ ਹੈ ਮੈਂ ਬਿਲਕੁਲ ਵੀ ਇਹਦੇ ਹੱਕ ਦੇ ਵਿੱਚ ਨਹੀਂ ਹਾਂ ਮੈਂ ਖੁਦ ਜਦੋਂ ਸਕੂਲ ਦੇ ਵਿੱਚ ਪੜ੍ਹਦੀ ਸੀ ਮੈਂ ਬਹੁਤ ਹੀ ਲਗਨ ਦੇ ਨਾਲ ਸਕੂਲ ਦੇ ਵਿੱਚ ਪੜ੍ਹਦੀ ਸੀ ਅਤੇ ਉਸ ਤੋਂ ਬਾਅਦ ਘਰ ਹੀ ਰਹਿੰਦੀ ਸੀ ਅਤੇ ਆਪਣਾ ਕੰਮ ਘਰ ਆਪਣੇ ਪੇਰੈਂਟਸ ਦੀ ਹੈਲਪ ਦੇ ਨਾਲ ਕਰਦੀ ਸੀ ਇਸ ਤੋਂ ਸਿਵਾ ਮੈਨੂੰ ਕਦੀ ਵੀ ਕਿਸੇ ਟਿਊਸ਼ਨ ਜਾਂ ਐਕਸਟਰਾ ਕਲਾਸ ਦੀ ਜ਼ਰੂਰਤ ਨਹੀਂ ਪਈ ਸੀ ਮੈਂ ਹੁਣ ਜੋ ਕਿ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਕੰਮ ਕਰ ਰਹੀ ਹਾਂ ਮੇਰਾ ਇੱਕ ਬਹੁਤ ਹੀ ਬਿਜ਼ੀ ਸ਼ਡਿਊਲ ਹੈ ਪਰ ਇਸ ਦੇ ਬਾਵਜੂਦ ਵੀ ਮੇਰਾ ਇੱਕ ਸੱਤ ਸਾਲ ਦਾ ਬੱਚਾ ਹੈ ਜੋ ਕਿ ਦੂਸਰੀ ਕਲਾਸ 'ਚ ਪੜ੍ਹਦਾ ਹੈ ਮੈਂ ਉਸਨੂੰ ਕੋਈ ਵੀ ਟਿਊਸ਼ਨ ਜਾਂ ਪ੍ਰਾਈਵੇਟ ਕਲਾਸ 'ਤੇ ਨਹੀਂ ਲਗਾਇਆ ਪਰ ਮੈਂ ਉਹਨੂੰ ਖੁਦ ਪੜ੍ਹਾਉਂਦੀ ਹਾਂ ਉਹਨੂੰ ਖੁਦ ਸਾਰਾ ਕੰਮ ਕਰਵਾਉਂਦੀ ਹਾਂ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਉਹਦੀ ਮੈਂ ਆਪ ਉਹਦੀ ਹੈਲਪ ਕਰਦੀ ਹਾਂ ਇਸ ਤੋਂ ਸਿਵਾ ਜੋ ਉਸਦੇ ਕੋਲ ਸਮਾਂ ਬਚਦਾ ਹੈ ਮੈਂ ਉਸ ਨੂੰ ਖੇਡਾਂ ਦੇ ਵਿੱਚ ਪਾਇਆ ਹੋਇਆ ਹੈ ਉਹ ਰੋਜ਼ ਸ਼ਾਮ ਨੂੰ ਫੁੱਟਬਾਲ ਖੇਡਣ ਜਾਂਦਾ ਹੈ ਅਤੇ ਆਪਣਾ ਜਿਹੜੀ ਜਿੰਨਾ ਵੀ ਕੀ ਜਿਸ ਵਿੱਚ ਵੀ ਉਹਦੀ ਰੁਚੀ ਹੈ ਅੱਗੇ ਮੈਂ ਉਸ ਦੇ ਨਾਲ ਸਾਥ ਦੇਵਾਂਗੀ ਪਰ ਮੈਂ ਸਮਝਦੀ ਹਾਂ ਕਿ ਸਕੂਲ ਟਾਈਮ ਦੇ ਵਿੱਚ ਜਦੋਂ ਬੱਚਾ ਸਕੂਲ 'ਚ ਪੜ੍ਹਾਈ ਕਰ ਰਿਹਾ ਹੈ ਤਾਂ ਉਸ ਨੂੰ ਕਿਸੇ ਵੀ ਟਿਊਸ਼ਨ ਜਾਂ ਪ੍ਰਾਈਵੇਟ ਕਲਾਸ ਦੀ ਜ਼ਰੂਰਤ ਨਹੀਂ ਹੈ